ਸਾਡੇ ਪਰਿਵਾਰ ਵਿੱਚ ਕੁਝ ਅਜਿਹੀਆਂ ਸੱਭਿਆਚਾਰਕ ਪਰੰਪਰਾਵਾਂ ਹਨ ਜਿਨ੍ਹਾਂ ਦਾ ਇੱਕ ਲੰਮਾ ਇਤਿਹਾਸ ਹੈ ਜਿਸ ਪ੍ਰਕਾਰ ਸਾਡੇ ਪੜਦਾਦਾ ਦੇ ਸਮੇਂ ਜਾਂ ਸਾਡੇ ਦਾਦਾ ਦੇ ਸਮੇਂ ਫੇਰ ਹੁਣ ਸਾਡੇ ਪਿਤਾ ਦੇ ਸਮੇਂ ਵੀ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਤਿਉਹਾਰਾਂ ਨਾਲ ਸੰਬੰਧਿਤ ਵਿਆਹ ਨਾਲ ਸੰਬੰਧਿਤ ਜਿਸ ਪ੍ਰਕਾਰ ਸਾਨੂੰ ਯਾਦ ਹੈ ਕਿ ਜਦੋਂ ਦੁਸਹਿਰੇ ਦਾ ਤਿਉਹਾਰ ਹੁੰਦਾ ਸੀ ਤਾਂ ਘਰ ਦੇ ਵਿੱਚ ਗੰਨੇ ਚੂਪਣ ਦੇ ਲਈ ਲਿਆਂਦੇ ਜਾਂਦੇ ਸਨ ਅਤੇ ਉਹ ਅੱਜ ਵੀ ਉਸ ਤਰ੍ਹਾਂ ਲਿਆਂਦੇ ਜਾਂਦੇ ਨੇ ਦੀਵਾਲੀ ਦੇ ਸਮੇਂ ਅਸੀਂ ਛੋਟੇ ਛੋਟੇ ਸੀ ਜਦੋਂ ਲਛਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਉਹ ਅੱਜ ਵੀ ਉਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਇਸ ਪ੍ਰਕਾਰ ਜਦੋਂ ਵਿਆਹ ਹੁੰਦਾ ਤਾਂ ਵਿਆਹ ਚਾਹੇ ਮੁੰਡੇ ਦਾ ਹੋਏ ਚਾਹੇ ਕੁੜੀ ਦਾ ਹੋਏ ਉਸਨੂੰ ਖਾਰਿਓਂ ਮਾਮਾ ਹੀ ਉਤਾਰਦਾ ਹੈ ਅਤੇ ਮਾਮੇ ਵੱਲੋਂ ਉਸਨੂੰ ਕੋਈ ਨਾ ਕੋਈ ਸ਼ਗਨ ਵਜੋਂ ਸੋਨੇ ਦੀ ਜ ਜਿਵੇਂ ਮੁੰਦਰੀ ਹੋ ਜਾਵੇਗੀ ਜਾਂ ਕੜਾ ਜਾਂ ਫਿਰ ਕੋਈ ਵੀ ਸੋਨੇ ਦੀ ਚੀਜ਼ ਪਾਈ ਜਾਂਦੀ ਸੀ ਅਤੇ ਉਹ ਅੱਜ ਵੀ ਪਾਈ ਜਾਂਦੀ ਹੈ ਜਿਵੇਂ ਭਰਜਾਈਆਂ ਵੱਲੋਂ ਘੋੜੀ ਚੜ੍ਹਦੇ ਦਿਓਰ ਨੂੰ ਸੁਰਮਾ ਪਾਇਆ ਜਾਂਦਾ ਸੀ ਅਤੇ ਅੱਜ ਵੀ ਉਹ ਰਸਮ ਅਦਾ ਕੀਤੀ ਜਾਂਦੀ ਹੈ ਇਸ ਪ੍ਰਕਾਰ ਜਦੋਂ ਪੁੱਤਰ ਡੋਲੀ ਲੈ ਕੇ ਘਰ ਆਉਂਦਾ ਤਾਂ ਮਾਂ ਵੱਲੋਂ ਪੁੱਤਰ ਦੀ ਨਜ਼ਰ ਉਤਾਰਨ ਦੇ ਲਈ ਇੱਕ ਤਰ੍ਹਾਂ ਨਾਲ ਸਿਰ ਤੋਂ ਪਾਣੀ ਵਾਰਿਆ ਜਾਂਦਾ ਸੀ ਅਤੇ ਉਹ ਅੱਜ ਵੀ ਕੀਤਾ ਜਾਂਦਾ ਅਤੇ ਜੇ ਧੀ ਦੀ ਡੋਲੀ ਤੋਰ ਰਹੇ ਹਾਂ ਤਾਂ ਉਹ ਆਪਣੀ ਝੋਲੀ ਝੋਲੀ ਦੇ ਵਿੱਚ ਕੱਚੇ ਚੌਲ ਪਾ ਕੇ ਪਿਛਾਂਹ ਨੂੰ ਸੁੱਟਦੀ ਹੈ ਆਪਣੇ ਪੇਕੇ ਘਰ ਦੀ ਖੁਸ਼ੀ ਮੰਗਦੀ ਹੈ ਤਾਂ ਉਹ ਸਾਡੀਆਂ ਭੂਆ ਨੇ ਵੀ ਕੀਤਾ ਫੇਰ ਅਸੀਂ ਵੀ ਕੀਤਾ ਅਤੇ ਅੱਗੋਂ ਵੀ ਕੀਤਾ ਜਾਵੇਗਾ ਜਦੋਂ ਮੇਰੀ ਭਤੀਜੀ ਦਾ ਜਾਂ ਕਿਸੇ ਵੀ ਘਰ ਦੇ ਵਿੱਚ ਕੁੜੀ ਦਾ ਵਿਆਹ ਹੋਵੇਗਾ ਇਸ ਪ੍ਰਕਾਰ ਸੱਭਿਆਚਾਰਕ ਪਰੰਪਰਾਵਾਂ ਨੇ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ